ਹੈਲੋ ਸਰ ਐਮਾਜੋਨ ਤੋਂ ਬੋਲਦੇ ਸਰ ਮੈਂ ਪ੍ਰਡੈਕਟ ਤੁਹਾਡੇ ਕੋਲ ਮੰਗਵਾਏ ਸੀ ਪਹਿਲਾਂ ਬੱਚਿਆਂ ਦੇ ਪੈਨਸਲਸ ਕਲਰ ਸਰ ਉਹ ਪ੍ਰਡੈਕਟ ਤੁਹਾਡੇ ਬਹੁਤ ਵਧੀਆ ਨਿਕਲੇ ਸਰ ਉਹਦੀ ਕੋਈ ਕੰਪਲੇਂਟ ਨਹੀਂ ਸੀ ਬਾਅਦ ਵਿੱਚ ਸਰ ਉਸ ਤੋਂ ਬਾਅਦ ਮੈਂ ਮੰਗਵਾਇਆ ਸੀ ਕਿਚਨ ਦਾ ਸਮਾਨ ਮੰਗਵਾਇਆ ਸੀ ਜੇ ਜਿਹਦੇ ਵਿੱਚ ਹੈਗਾ ਸੀ ਸਟੀਲ ਦਾ ਛਾਨਣਾ ਡੱਬੇ ਰੱਖਣ ਵਾਸਤੇ ਸਰ ਉਹ ਜਿਹੜਾ ਅਸੀਂ ਐਡ ਦੇਖੀ ਸੀ ਉਹਦੇ ਵਿੱਚ ਉਸਦਾ ਸਾਈਜ਼ ਜੋ ਅਸੀਂ ਇਹ ਨਾ ਉਸ ਉਹ ਬਹੁਤ ਹੀ ਸੋ ਮੀਡੀਅਮ ਸਾਈਜ਼ ਸੀ ਇਹ ਨਾ ਸਰ ਬ ਤੁਸੀਂ ਉਹ ਮੀਡੀਅਮ ਸਾਈਜ਼ ਤੋਂ ਵੀ ਛੋਟਾ ਸਾਈਜ਼ ਇਹ ਨਾ ਭੇਜਿਆ ਵਾ ਸਰ ਜੋ ਕਿ ਸਾਡੇ ਕਿਸੇ ਕੰਮ ਨਹੀਂ ਇਹ ਨਾ ਆ ਰਿਹਾ ਸਰ ਸਰ ਮੈਂ ਇਹ ਐਪ ਦੇਖ ਕੇ ਜਦੋਂ ਅਸੀਂ ਮੰਗਵਾਇਆ ਪ੍ਰੋਡੈਕਟ ਦੇਖ ਕੇ ਬਹੁਤ ਪਰੇਸ਼ਾਨ ਹੋਏ ਇਹ ਨਾ ਵੀ ਅਸੀਂ ਉਸਦੇ ਅਕੋਰਡਿੰਗ ਪੈਸੇ ਵੀ ਇੰਨਾ ਖਰਚ ਦਿੱਤੇ ਇਹ ਨਾ ਪਰ ਸਾਨੂੰ ਜੋ ਚੀਜ਼ ਸਾਨੂੰ ਚਾਹੀਦੀ ਸੀ ਉਹ ਚੀਜ਼ ਮਿਲੀ ਨਹੀਂ ਹੈਗੀ ਸਰ ਪਲੀਜ਼ ਇੰਨਾ ਵਾ ਵੀ ਅੱਗੇ ਤੋਂ ਇਸ ਤਰ੍ਹਾਂ ਨਾ ਕਰਿਆ ਕਰੋ ਜਿਹੜੀ ਚੀਜ਼ ਮੰਗਵਾਈ ਹੁੰਦੀ ਹੈ ਉਹ ਹੀ ਸਾਨੂੰ ਭੇਜਿਆ ਕਰੋ ਇਹ ਨਾ ਐਡ ਜੋ ਵੀ ਹੁੰਦੀ ਹੈ ਇਹ ਨਾ ਐਡ 'ਚ ਹੁੰਦੀ ਹੈ ਉਹ ਹੀ ਚੀਜ਼ ਭੇਜਿਆ ਕਰੋ ਇਸ ਤਰ੍ਹਾਂ ਇਹ ਨਾ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਹਨ ਤੁਸੀਂ ਜਿਹੜਾ ਰੈਕ ਭੇਜਿਆ ਵਾ ਇਹ ਨਾ ਤੁਸੀਂ ਉਹਦੇ ਸਟੈਂਡ ਵੀ ਇਹ ਨਾ ਵਾ ਵੀ ਟੁੱਟੇ ਪਏ ਆ ਸਟੀਲ ਦੀਆਂ ਤਾਰਾਂ ਜਿਹੜੀਆਂ ਉਹ ਉਹ ਵਿੰਗੀਆਂ ਹੋਈਆਂ ਪਈਆਂ ਹੈ ਉਹ ਸਾਡੀ ਕਿਸੇ ਕੰਮ ਦਾ ਨਹੀਂ ਸਾਡੇ ਪੈਸੇ ਵੇਸਟ ਇਸ ਤਰ੍ਹਾਂ ਹੋਏ ਇਹ ਨਾ ਸਰ ਅੱਗੇ ਤੋਂ ਇਹ ਨਾ ਕੋਈ ਵੀ ਚੀਜ਼ ਜਿਹ ਮੰਗਵਾਈਏ ਜਿਸ ਤਰ੍ਹਾਂ ਜੋ ਵੀ ਐਡ 'ਚ ਹੁੰਦਾ ਹੈ ਉਹਦੇ ਅਕੋਰਡਿੰਗ ਹੀ ਭੇਜਿਆ ਕਰੋ ਇਹ ਨਾ ਓਕੇ